ਹੈਲੋ ਰਜਿੰਦਰ ਜੀ ਇੱਕ ਗੱਡੀ ਦਿੱਤੀ ਸੀ ਤੁਹਾਨੂੰ ਆਈ ਟਵੈਂਟੀ ਪਰਸੋਂ ਉਹਦਾ ਕੰਮ ਹੋ ਗਿਆ ਵੀਰੇ ਇਕ ਤਾਂ ਏ ਸੀ ਦੀ ਏ ਸੀ ਦੀ ਕੂਲਿੰਗ ਦੀ ਉਹਦੀ ਮੇਨ ਪ੍ਰੋਬਲਮ ਸੀਗੀ ਤੈਨੂੰ ਦੱਸਿਆ ਸੀ ਮੈਂ ਅਤੇ ਇੱਕ ਉਹਦੀ ਨਾ ਹੈਡਲਾਈਟ ਦੀ ਵੀ ਥੋੜ੍ਹੀ ਹੈਗੀ ਬੀਮ ਹਾ ਹਾਈ ਬੀਮ ਜਿਹੀ ਨਾ ਉਹ ਸਹੀ ਨਹੀਂ ਮਤਲਬ ਪੈਂਦੀ ਥੱਲਿਓ ਪੈਂਦੀ ਆ ਥੋੜ੍ਹੀ

ਠੀਕ ਹੈ ਹਾਂ ਓ ਨਹੀਂ ਖੋਲ ਕੇ ਕਿੰਨਾ ਕੁ ਕਿੰਨਾ ਕੁ ਪੈ ਜੂਗਾ ਵੀਰੇ ਦਸ ਹਜ਼ਾਰ ਦਾ ਆਜੂਗਾ ਕੰਮ ਤਾਂ ਇਕਦਮ ਓਕੇ ਹੋਜੂਗਾ ਚੀਜ਼ਾਂ ਤਾਂ ਸਾਰੀਆਂ ਫਿਰ ਔਰਿਜਨਲ ਹੀ ਹਾਂਜੀ ਅੱਛਾ ਕੰਪਨੀ ਦਾ ਹੀ ਵੀਰੇ ਗਰੰਟੀ ਵਰੰਟੀ ਪੂਰੀ ਹੋ ਜਾਊਗੀ ਉਹਦੀ ਮਤਲਬ ਹੈਂ ਠੀਕ ਹੈ ਉਹ ਤਾਂ ਦੁਬਾਰਾ ਅਤੇ ਫਿਰ ਵੀਰੇ ਐਂ ਨਾ ਰੋਜ਼ ਡੇ ਰੋਜ਼ ਰੋਜ਼ ਲੈ ਕੇ ਨਹੀਂ ਆਈ ਜਾਂਦੀ ਨਾ ਗੱਡੀ ਫਿਰ ਗਰਮੀ ਤਾਂ ਗੱਡੀ ਬਿਨਾਂ ਵੀ ਔਖਾ ਹੋ ਜਾਂਦਾ ਤਾਂ ਕਰਕੇ ਠੀਕ ਹੈ ਵੀਰੇ ਹਾਂਜੀ ਹਾਂਜੀ ਅਤੇ ਇਹਦੀ ਸੀਟ ਵੀ ਨਾ ਪਿੱਛੇ ਜਿਵੇਂ ਕਰਦੇ ਨਾ ਆਪਾਂ ਤਾਂ ਉਹ ਵੀ ਨਹੀਂ ਹੁੰਦੀ ਮਤਲਬ ਜਿੱਦਾਂ ਕਿ ਥੱਲੇ ਕੋਈ ਨੈੱਟ ਨੁੱਟ ਦਾ ਕੋਈ ਉਹ ਰੌਲਾ ਪਿਆ ਹੋਵੇ ਪਤਾ ਨਹੀਂ ਕੀ ਹੈ ਅਤੇ ਉਹ ਵੀ ਤੁਸੀਂ ਦੇਖ ਲਿਓ ਡਰਾਈਵਿੰਗ ਸੀਟ ਨਾ ਡਰਾਈਵਿੰਗ ਡਰਾਈਵਿੰਗ ਸੀਟ ਨੂੰ ਆਪਾਂ ਕੰਫਰਟ ਕਰਨ ਲਈ ਪਿੱਛੇ ਕਰਦੇ ਨਾ ਉਹ ਹੁੰਦੀ ਨਹੀਂ ਅੜ ਜਾਂਦੀ ਹੈ ਵਿੱਚੇ ਹਾਂਜੀ ਹਾਂਜੀ ਹੈ ਨਾ ਤਾਂ ਉਹ ਲੋਕ ਨਵੇਂ ਪਾ ਦਿਓ ਵੀਰੇ ਅਤੇ ਨਾਲੇ ਉਹ ਤੁਸੀਂ ਉਹ ਦੇਖ ਲਿਓ ਆਪਣੇ ਹੈਡਲਾਈਟਾਂ ਅਤੇ ਉਹ ਵੀ ਆਪਣਾ ਏ ਸੀ ਏ ਸੀ ਦੀ ਗੈਸ ਪਊਗੀ ਗੈਸ ਖਤਮ ਹੈ ਜਾਂ ਕੀ ਰੋਲਾ ਹੈ ਤੁਸੀਂ ਦੇਖਿਆ ਸੀ ਕੇ ਅੱਛਾ ਅੱਛਾ ਮਿੱਟੀ 'ਤੇ ਚੱਲੀ ਹੈ ਫਿਰ ਨਾ ਉਹ ਮਿੱਟੀ 'ਤੇ ਚੱਲੀ ਹੈ ਤਾਂ ਕਰਕੇ ਹੋ ਗਈ ਹੋਣੀ ਹੂੰ ਹੂੰ ਹੂੰ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਕਰਾ ਕੇ ਜਮਾਂ ਓਕੇ ਕਰਕੇ ਵੀਰੇ ਵੋਸ਼ਿੰਗ ਵੀ ਕਰਵਾ ਦਿਓ ਫਿਰ ਵਾਸ਼ਿੰਗ ਵਾਸ਼ਿੰਗ ਕਿੱਥੋ ਕਰਾ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਫਿਰ ਕਦੋਂ ਲੈ ਕੇ ਜਾਵਾਂ ਮੈਂ

ਠੀਕ ਹੈ ਜੀ ਠੀਕ ਹੈ ਕਿੰਨੇ ਕਿੰਨੇ ਕੁ ਪ ਪੈਸੇ ਜੇਬ 'ਚ ਪਾ ਕੇ ਲੈ ਆਵਾਂ ਮੈਂ ਆਈਡੀਏ ਨਾਲ ਹੋ ਜੂ ਦਸ ਪੰਦਰਾਂ ਪੰਦਰਾਂ ਹਜ਼ਾਰ ਮੈਕਸ ਆ ਵੀਰੇ ਪੰਦਰਾਂ ਹਜ਼ਾਰ ਤੱਕ ਤਾਂ ਹੋਈ ਜੂਗਾ ਸਾਰਾ ਕੰਮ ਨਾ ਮਿਲਾ ਕੇ ਬਸ ਬਸ ਠੀਕ ਹੈ ਵੀਰੇ ਬਹੁਤ ਬਹੁਤ ਮਿਹਰਬਾਨੀ ਹੋਊਗੀ ਨਾ ਠੀਕ ਹੈ ਵੀਰੇ ਥੈਂਕ ਯੂ ਮਿਲਦੇ ਹਾਂ ਫਿਰ ਆਉਂਦਾ ਓਕੇ ਬਰੋ